ਪਾਣੀ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹੈ ਪਾਣੀ ਤੋਂ ਵਗੈਰ ਮਨੁੱਖੀ ਜੀਵਨ ਨਹੀਂ ਜੀ ਸਕਦਾ ਹਾਂਜੀ ਸਾਨੂੰ ਪਾਣੀ ਦੀ ਸਪਲਾਈ ਮਿਲਦੀ ਹੈ ਸਾਡੇ ਪਿੰਡ ਟੂਟੀ ਦਾ ਪਾਣੀ ਦੋ ਟੈਮ ਸਵੇਰੇ ਅਤੇ ਸ਼ਾਮ ਨੂੰ ਅਉਂਦਾ ਹੈ ਜੇ ਮੈਨੂੰ ਟੂਟੀ ਦਾ ਪਾਣੀ ਮਿਲੇ ਤਾਂ ਮੇਰਾ ਜੀਵਨ ਬਹੁਤ ਸੌਖਾ ਹੋ ਸਕਦਾ ਹੈ ਪਾਣੀ ਬਿਨਾਂ ਜ਼ਿੰਦਗੀ ਬੜੀ ਔਖੀ ਬਣ ਜਾਂਦੀ ਹੈ ਜੇ ਇਹ ਢੁੱਕਵੀਂ ਮਾਤਰਾ 'ਚ ਸਾਫ਼ ਮਿਲ ਜਾਵੇ ਤਾਂ ਬਹੁਤ ਸਾਰੀਆਂ ਤਕਲੀਫ਼ਾਂ ਦੂਰ ਹੋ ਸਕਦੀਆਂ ਹਨ ਦੂਰੋਂ ਪਾਣੀ ਲੈਣ ਜਾਣ ਨਹੀਂ ਪੈਣਾ ਜਿਸ ਕਰਕੇ ਸਮਾਂ ਅਤੇ ਜੋਰ ਬਚੂ ਜੇ ਪਾਣੀ ਵਧੀਆ ਅਤੇ ਸਾਫ਼ ਹੋਵੇ ਤਾਂ ਬਿਮਾਰੀਆਂ ਜਿਵੇਂ ਕਿ ਬੁਖਾਰ ਪੇਟ ਵਿੱਚ ਗੜਬੜ ਨਹੀਂ ਲੱਗਣੀਆਂ ਰੋਜ਼ਾਨਾ ਦੇ ਕੰਮ ਜਿਵੇਂ ਕਿ ਨਹਾਉਣਾ ਧੋਣਾ ਰੋਟੀ ਪਕਾਉਣਾ ਅਸਾਨ ਹੋ ਜਾਣਗੇ ਜੇ ਪਾਣੀ ਚੰਗੀ ਤਰ੍ਹਾਂ ਮਿਲੇ ਤਾਂ ਖੇਤੀਬਾੜੀ ਅਤੇ ਛੋਟੇ ਉਦਯੋਗ ਵੀ ਵਧੀਆ ਤਰੀਕੇ ਨਾਲ ਚੱਲਣਗੇ ਮਾੜੇ ਪਾਣੀ ਕਰਕੇ ਪੇਟ ਦੀਆਂ ਬਿਮਾਰੀਆਂ ਵਧਣਗੀਆਂ ਦੂਰੋਂ ਪਾਣੀ ਲੈਣ ਜਾਣਾ ਪੈ ਸਕਦਾ ਜੋ ਥਕਾਵਟ ਭਰੀ ਗੱਲ ਹੈ ਜੇ ਪਾਣੀ ਨਾ ਹੋਵੇ ਤਾਂ ਨਹਾਉਣਾ ਧੋਣਾ ਰੋਟੀ ਰਸੋਈ ਕਰਨੀ ਵੱਡੀ ਮੁਸ਼ਕਿਲ ਹੋ ਜਾਵੇਗੀ ਧੰਨਵਾਦ ਜੀ